ਆਮ ਕਰਕੇ ਜਦੋਂ ਕਿਸੇ ਬਜ਼ੁਰਗ ਜਾਂ ਕਿਸੇ ਦੀ ਡੈਥ ਹੋ ਜਾਂਦੀ ਹੈ ਤਾਂ ਉੱਥੇ ਇੱਕ ਇਹੀ ਮੁੱਖਵਾਕ ਜਿਹੜਾ ਵਾਕ ਮੇਨ ਵਾਕ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਇ ਵਰਤਿਆ ਜਾਂਦਾ ਹੈ ਜਿਵੇਂ ਗੱਲ ਮੁਹਾਵਰੇ ਦੀ ਕਰੀਏ ਹੁੰਦੇ ਤੀਗੇ ਪਰ ਜਿਵੇਂ ਉਲਟਾ ਚੋਰ ਕੁਤਬਾਲ ਕੋ ਡਾਂਟੇ